ਜਦੋਂ ਮੈਂ ਪੜ੍ਹਾਈ ਸ਼ੁਰੂ ਕੀਤੀ ਮੈਂ ਡਿਗਰੀ ਦੇ ਵਿੱਚ ਬੀ ਐੱਸ ਸੀ ਐਗਰੀਕਲਚਰ ਸ਼ੁਰੂ ਕੀਤੀ ਤਾਂ ਉਸ ਟਾਈਮ ਮੈਨੂੰ ਘਰਦਿਆਂ ਨੇ ਵੀ ਕਿਹਾ ਵੀ ਮਤਲਬ ਤੂੰ ਸਾਇੰਸ ਦੀ ਪੜ੍ਹਾਈ ਕੀਤੀ ਹੈ ਤਾਂ ਇਸਦੇ ਵਿੱਚ ਇਹ ਲਾਈਨ 'ਚ ਕਿਉਂ ਆ ਰਿਹਾ ਤਾਂ ਮੈਨੂੰ ਮੇਰੇ ਇੱਕ ਮੇਰਾ ਮਿੱਤਰ ਸੀ ਉਸਨੇ ਮੈਨੂੰ ਚੰਗੀ ਸਲਾਹ ਦਿੱਤੀ ਕਿ ਤੂੰ ਖੇਤੀਬਾੜੀ ਦੀ ਵੀ ਕਰ ਰਿਹਾ ਨਾਲ ਦੀ ਨਾਲ ਤਾਂ ਮਤਲਬ ਜੇ ਤੂੰ ਖੇਤੀਬਾੜੀ ਨਾਲ ਨਾਲ ਬੀ ਐੱਸ ਸੀ ਐਗਰੀਕਲਚਰ ਦਾ ਕੋਰਸ ਕਰੇ ਤਾਂ ਤੈਨੂੰ ਵਧੀਆ ਅੱਗੇ ਮਤਲਬ ਕੁਛ ਨਾ ਕੁਛ ਸਿੱਖਣ ਨੂੰ ਮਿਲੇਗਾ